ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਭੰਗੜਾ ਹੈ ਇਹ ਗੱਭਰੂਆਂ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਆਮ ਤੌਰ 'ਤੇ ਭੰਗੜੇ ਦੇ ਪ੍ਰਦਰਸ਼ਨ ਦੀ ਆਮ ਤੌਰ 'ਤੇ ਗੱਭਰੂ ਚਾਦਰਾਂ ਅਤੇ ਕੁੜਤਾ ਪਾਉਂਦੇ ਹਨ ਜਿਸ ਨਾਲ ਉਹ ਜੁਗਨੀਆਂ ਪਾਉਂਦੇ ਹਨ ਗਲਾਂ ਦੇ ਵਿੱਚ ਕੈਂਠੇ ਪਾਉਂਦੇ ਹਨ ਅਤੇ ਉਹਨਾਂ ਦੇ ਕੰਨਾਂ ਦੇ ਵਿੱਚ ਨੱਤੀਆਂ ਪਾਈਆਂ ਹੁੰਦੀਆਂ ਹਨ ਅਤੇ ਕਮਰ 'ਤੇ ਉਹਨਾਂ ਦੇ ਕਮਰਬੰਦ ਬੰਨ੍ਹਿਆਂ ਬੰਨ੍ਹਿਆਂ ਹੁੰਦਾ ਹੈ ਕੰਨਾਂ ਦੇ ਵਿੱਚ ਨੱਤੀਆਂ ਪਾਈਆਂ ਹੁੰਦੀਆਂ ਹਨ ਪੈਰਾਂ ਵਿੱਚ ਘੁੰਗਰੂ ਹੁੰਦੇ ਹਨ ਉਹਨਾਂ ਦੇ ਪੈਰਾਂ ਦੇ ਵਿੱਚ ਜੁੱਤੀ ਪਾਈ ਹੁੰਦੀ ਹੈ ਜਿਸ ਜਿਸ ਨੂੰ ਆਪਾਂ ਨੋਕ ਵਾਲੀ ਜੁੱਤੀ ਵੀ ਕਹਿੰਦੇ ਹਾਂ ਉਹਨਾਂ ਦੇ ਕੁੜਤਿਆਂ ਦੇ ਨਾਲ ਉਹਨਾਂ ਦੇ ਜਾਕਟ ਪਾਈ ਹੁੰਦੀ ਹੈ ਅਤੇ ਬਾਹਾਂ ਦੇ ਵਿੱਚ ਕਲੀਰੇ ਬੰਨ੍ਹੇ ਹੁੰਦੇ ਹਨ ਅਤੇ ਬਹੁਤ ਸੋਹਣੇ ਲੱਗ ਰਹੇ ਹੁੰਦੇ ਹਨ ਉਹ ਇਹ ਪੁਸ਼ਾਕਾਂ ਸਾਰੇ ਗੱਬਰੂ ਭੰਗੜੇ ਵਾਲੇ ਗੱਭਰੂਆਂ ਦੇ ਜੋ ਪਾਈਆਂ ਹੁੰਦੀਆਂ ਹਨ ਇਹ ਕਿਸੇ ਹੋਰ ਦੇ ਨਹੀਂ ਪਾਈਆਂ ਹੁੰਦੀਆਂ ਅਤੇ ਉਹਨਾਂ ਦੀ ਸਭ ਤੋਂ ਵੱਖਰੀ ਪਹਿਚਾਣ ਹੁੰਦੀ ਹੈ ਕਿਉਂਕਿ ਇਹ ਪੁਸ਼ਾਕ ਉਹਨਾਂ ਨੂੰ ਵੱਖਰੀ ਪਹਿ ਪਹਿਚਾਣ ਦਿੰਦੀਆਂ ਹਨ ਜੋ ਕਿ ਕਿਸੇ ਹੋਰ ਦੇ ਨਹੀਂ ਪਾਈਆਂ ਹੁੰਦੀਆਂ ਇਸ ਕਰਕੇ ਉਹਨਾਂ ਨੂੰ ਇਹ ਆਕਰਸ਼ਿਤ ਬਣਾਉਂਦੀਆਂ ਹਨ ਅਤੇ ਸਭ ਤੋਂ ਵੱਖਰੀ ਪਹਿਚਾਣ ਦਿੰਦੀਆਂ ਹਨ